ਬਿਲਕੁਲ ਜੀ ਸਾਡੀ ਜਿਹੜੀ ਰੋਜ਼ੀ ਰੋਟੀ ਹੈ ਅੱਜ ਕੱਲ੍ਹ ਜਿਹੜੀ ਉਹ ਬਿਲਕੁਲ ਬਿਜਲੀ 'ਤੇ ਨਿਰਭਰ ਕਰ ਰਹੀ ਹੈ ਜੇਕਰ ਬਿਜਲੀ ਨਹੀਂ ਹੈ ਤਾਂ ਸਾਡੇ ਸਾਰੇ ਹੀ ਕੰਮ ਰੁਕ ਜਾਂਦੇ ਹੈ ਇੱਕ ਜਿਹੜਾ ਹੈ ਔਰਤ ਲਈ ਜਿਹੜਾ ਹੈ ਮਤਲਬ ਕਿਚਨ ਜਿਹੜਾ ਉਸਦੀ ਰਸੋਈ ਜਿਹੜੀ ਹੈ ਉਹ ਇੱਕ ਫੇਵਰਿਟ ਜਗ੍ਹਾ ਹੁੰਦੀ ਹੈ ਅਤੇ ਜੇ ਲਾ ਮਤਲਬ ਇਹ ਜਿਹੜੀ ਬਿਜਲੀ ਹੈ ਲਾਈਟ ਨਾ ਹੋਵੇ ਤਾਂ ਉਸਦੇ ਲਈ ਜਿਹੜਾ ਹੈ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਜਿਹੜਾ ਸ ਕੰਮ ਕਰਨਾ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਰੇ ਕੰਮ ਜਿਹੜੇ ਮਤਲਬ ਜੇ ਇਨਵਰਟ ਜੇ ਅਸੀਂ ਇੰਡਕਸ਼ਨ ਰੱਖਿਆ ਹੋਇਆ ਹੈ ਅਤੇ ਜਦ ਜੇਕਰ ਲਾਈਟ ਨਹੀਂ ਹੈ ਤਾਂ ਅਸੀਂ ਖਾਣਾ ਨਹੀਂ ਬਣਾ ਸਕਦੇ ਜਾਂ ਖਾਣਾ ਗਰਮ ਨਹੀਂ ਕਰ ਸਕਦੇ ਜਾਂ ਅਸੀਂ ਉਸਦੇ ਲਈ ਇੱਕ ਮਾਈਕ੍ਰੋਵੇਵ ਓਵਨ ਹੈ ਜੇ ਅਸੀਂ ਖਾਣਾ ਗਰਮ ਕਰਨਾ ਤਦ ਅਸੀਂ ਖਾਣਾ ਗਰਮ ਬਿਜਲੀ ਨਾ ਹੋਣ ਦੇ ਕਾਰਨ ਜਿਹੜਾ ਹੈ ਉਹ ਖਾਣਾ ਅਸੀਂ ਗਰਮ ਨਹੀਂ ਕਰ ਪਾਉਂਦੇ ਹਾਂ ਅਤੇ ਸਾਨੂੰ ਠੰਡਾ ਹੀ ਖਾਣਾ ਜਿਹੜਾ ਉਹ ਖਾਣਾ ਪੈਂਦਾ ਹੈ ਅਤੇ ਬਿਜਲੀ ਮਤਲਬ ਜਿਹੜਾ ਹੈਗਾ ਬਿਜਲੀ ਦੀ ਜਦੋਂ ਕੱਟ ਲੱਗਦੇ ਹੈ ਤਾਂ ਫਿਰ ਸਾਡੇ ਲਈ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਇਹਦੇ ਲਈ ਮਤਲਬ ਸਾਡੇ ਕੋਲ ਓਪਸ਼ਨ ਤਾਂ ਹੈ ਇਨਵਰਟਰ ਹੈ ਜਾਂ ਸੋਲਰ ਸਿਸਟਮ ਹੈਗੇ ਹੈ ਜਾਂ ਮੋਮਬੱਤੀ ਜਿਹੜੀ ਹੈ ਅਸੀਂ ਵਰਤ ਲੈਦੇ ਹਾਂ ਪਰ ਜੋ ਇਕ ਰੋਸ਼ਨ ਬਿਜਲੀ ਦੀ ਲਾਈਟ ਦੇ ਵਿੱਚ ਜਿਹੜਾ ਅਸੀਂ ਕੰਮ ਕਰ ਸਕਦੇ ਹਾਂ ਜਲਦੀ ਕਰ ਸਕਦੇ ਹਾਂ ਉਹ ਜਿਹੜਾ ਹੈ ਉਹ ਮਤਲਬ ਇਹਨਾਂ ਦੇ ਵਿੱਚ ਅਸੀਂ ਨਹੀਂ ਕਰ ਸਕਦੇ ਇਸ ਦੇ ਲਈ ਜਦੋਂ ਜੇ ਮਤਲਬ ਲਾਈਟ ਨਹੀਂ ਹੁੰਦੀ ਹੈ ਤਾਂ ਫਿਰ ਸਾਨੂੰ ਜਿਹੜਾ ਅਸੀਂ ਖਾਣਾ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਫਿਰ ਅਸੀਂ ਓਪਸ਼ਨ ਲੱਭਦੇ ਕਿ ਅਸੀਂ ਬਾਜ਼ਾਰੋਂ ਮੰਗਵਾ ਲਈਏ ਬਾਜ਼ਾਰੋਂ ਮੰਗਵਾਉਣ ਵਾਲਾ ਜਿਹੜਾ ਖਾਣਾ ਹੈ ਉਹ ਬਹੁਤਾ ਜ਼ਿਆਦਾ ਮਤਲਬ ਪੌਸ਼ਟਿਕ ਨਹੀਂ ਹੁੰਦਾ ਜਾਂ ਸਾਫ ਨਹੀਂ ਹੁੰਦਾ ਹੈ ਬਟ ਕਿਉਂਕਿ ਜੋ ਘਰ ਵਾਲੇ ਖਾਣੇ ਦੇ ਵਿੱਚ ਜਿਹੜਾ ਹੈਗਾ ਸਵਾਦ ਹੁੰਦਾ ਹੈ ਉਹ ਬਾਹਰ ਵਾਲੇ ਖਾਣੇ ਦੇ ਵਿੱਚ ਸਾਨੂੰ ਨਹੀਂ ਮਿਲਦਾ ਅਤੇ ਸਾਡੇ ਇੱਥੇ ਜਿਹੜਾ ਮਤਲਬ ਬਹੁਤ ਜ਼ਿਆਦਾ ਮਤਲਬ ਜਿਹੜੇ ਮਤਲਬ ਕੁਝ ਲੋਕ ਜਿਹੜੇ ਹੈਗੇ ਆ ਉਹ ਇਨਵਰਟਰ ਨੂੰ ਕਰ ਸਕਦੇ ਹੈ ਪਰ ਬਹੁਤ ਲੋਕ ਜਿਹੜੇ ਹੈ ਉਹ ਇਨਵਰਟਰ ਦੀ ਸਹੂਲਤ ਜਿਹੜੀ ਹੈ ਉਸਨੂੰ ਨਹੀਂ ਲੈ ਸਕਦੇ